ਸਤਿ ਸ਼੍ਰੀ ਅਕਾਲ ਜੀ ਡੋਮੀਨੋਜ਼ ਪੀਜ਼ਾ ਤੋਂ ਗੱਲ ਕਰ ਰਹੇ ਹੋ ਜੀ ਮੈਂ ਦੋ ਘੰਟੇ ਪਹਿਲਾਂ ਆਪਣੇ ਘਰ ਦੇ ਐਡਰੈੱਸ 'ਤੇ ਆਪਣੇ ਮੋਬਾਇਲ ਮੋਬਾਈਲ ਐਪ ਰਾਹੀਂ ਔਡਰ ਕੀਤਾ ਸੀਗਾ ਜਿਹਦੇ ਵਿੱਚ ਇੱਕ ਬਰਗਰ ਇੱਕ ਪੀਜ਼ਾ ਅਤੇ ਸੈਂਡਵਿੱਚ ਅਤੇ ਕੋਲਡਰਿੰਕ ਵਗੈਰਾ ਸੀਗੇ ਅਤੇ ਮੇਰੇ ਘਰੇ ਚਾਰ ਫਰੈਂਡਸ ਨੇ ਆਉਣਾ ਸੀਗਾ ਬਟ ਹੁਣ ਮੇਰੇ ਜੋ ਫਰੈਂਡਸ ਆ ਰਹੇ ਸੀਗੇ ਉਹਨਾਂ ਦਾ ਪਲੈਨ ਕਿਤੇ ਕੈਂਸਲ ਹੋਣ ਕਾਰਨ ਜਿਹੜਾ ਮੈਂ ਔਡਰ ਹੈ ਤੁਹਾਨੂੰ ਕੀਤਾ ਸੀਗਾ ਉਹ ਕੈਂਸਲ ਕਰਨਾ ਚਾਹੁੰਦਾ ਅਤੇ ਕਿਰਪਾ ਕਰਕੇ ਮੇਰਾ ਜਿਹੜਾ ਔਡਰ ਹੈਗਾ ਇਹ ਕੈਂਸਲ ਕੀਤਾ ਜਾਵੇ ਅਤੇ ਮੇਰੀ ਜਿਹੜੀ ਪੇਮੈਂਟ ਹੈ ਅੋਲਰੇਡੀ ਮੇਰੇ ਮੋਬਾਈਲ ਐਪ ਤੋਂ ਹੋ ਚੁੱਕੀ ਹੈ ਅਤੇ ਇਹਨੂੰ ਵਾਪਸ ਵੀ ਭੇਜਿਆ ਜਾਵੇ ਅਤੇ ਧੰਨਵਾਦ ਜੀ